ਪੰਜਾਬ ਦੀਆਂ ਬਹੁਤ ਸਾਰੀਆਂ ਟੈਕਨੋਲੋਜਿਜ ਇੱਦਾਂ ਦੀਆਂ ਨੇ ਜਿਹਨਾਂ ਨੇ ਬਹੁਤ ਹੀ ਜ਼ਿਆਦਾ ਸਫਲਤਾਵਾਂ ਹਾਸਿਲ ਕੀਤੀਆਂ ਨੇ ਜਿਵੇਂ ਕਿ ਸੋਫਟਵੇਅਰ ਕੰਪਨੀ ਹੋ ਗਈ ਪੰਜਾਬ ਟੈਕ ਹੈ ਨਾ ਉਹਨੇ ਵੀ ਬਹੁਤ ਹੀ ਵਧੀਆ ਸਫਲਤਾ ਹਾਸਲ ਕੀਤੀ ਆ ਅਲੱਗ ਅਲੱਗ ਸੋਫਟਵੇਅਰਸ ਹੋ ਗਏ ਜਿਹੜੇ ਕਿ ਅੱਜ ਕੱਲ੍ਹ ਬਹੁਤ ਚੱਲ ਰਹੇ ਨੇ ਹੋਰ ਵੀ ਕੰਪਨੀਜ ਹੋ ਗਈਆਂ ਟੈਕਨੋਲੋਜਿਜ ਹੋ ਗਈਆਂ ਜਿਵੇਂ ਕਿ ਜਸਟ ਐਲ ਹੋ ਗਈ ਲਿੰਕਡ ਇਨ ਹੋ ਗਈ ਇਹਨਾਂ ਨੇ ਵੀ ਬਹੁਤ ਹੀ ਉੱਚ ਪੱਧਰ 'ਤੇ ਸਫਲਤਾ ਹਾਸਲ ਕੀਤੀ ਹੈ ਗਰੇ ਫੂ ਫੂਡ ਗਰੇਨ ਦੀਆਂ ਕੰਪਨੀਜ਼ ਹੋ ਗਈਆਂ ਜਿਵੇਂ ਕਿ ਏਵਨ ਸਾਈਕਲ ਵੀ ਹੋ ਗਈ ਸਾਈਕਲ ਕੰਪਨੀ ਬਹੁਤ ਜ਼ਿਆਦਾ ਮਸ਼ਹੂਰ ਆ ਲੁਧਿਆਣੇ ਦੀ ਓਜ਼ਰੀ ਮਿੱਲਜ ਹੋ ਗਈਆਂ ਇਹਨਾਂ ਦੀਆਂ ਜਿਹੜੀ ਟੈਕਨੋਲੋਜੀਜ ਨੇ ਇਹਨਾਂ ਨੇ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਸਫਲਤਾ ਹਾਸਲ ਕੀਤੀ ਆ ਜਿਵੇਂ ਪੀ ਸੀ ਟੀ ਈ ਗਰੁੱਪ ਆਫ ਇੰਸਟੀਟਿਊਟ ਕਾਲਜਸ ਹੋ ਗਏ ਅਤੇ ਹੋਰ ਵੀ ਜਿਵੇਂ ਕਾਲਜਸ ਹੋ ਗਏ ਸੀਟੀ ਯੂਨੀਵਰਸਿਟੀ ਹੋ ਗਈਆਂ ਲਵਲੀ ਯੂਨੀਵਰਸਿਟੀ ਹੋ ਗਈ ਇਹਨਾਂ ਨੇ ਸਭ ਨੇ ਬਹੁਤ ਹੀ ਜ਼ਿਆਦਾ ਸਫਲਤਾ ਹਾਸਿਲ ਕੀਤੀ ਆ ਨਿਊਜ਼ ਚੈਨਲ ਹੋ ਗਈ ਇਹ ਵੀ ਇੱਕ ਤਰ੍ਹਾਂ ਦੀ ਟੈਕਨੋਲੋਜੀ ਨੇ ਜਿਹੜੀਆਂ ਇਹਨਾਂ ਦੀਆਂ ਇਹਨਾਂ ਨੇ ਵੀ ਬਹੁਤ ਹੀ ਜ਼ਿਆਦਾ ਸਫਲਤਾ ਹਾਸਿਲ ਕੀਤੀ ਆ ਅੱਜ ਵੀ ਸੇਮ ਉਹੀ ਚੱਲ ਰਹੀਆਂ ਨੇ ਮਤਲਬ ਟੋਪ ਰੇਟਡ ਨੇ ਪੰ ਪੰਜਾਬ ਦੇ ਵਿੱਚ ਸਾਰੀਆਂ ਇਹ ਚੀਜ਼ਾਂ